ਸਤਿ ਸ਼੍ਰੀ ਅਕਾਲ ਜੀ ਨਿੱਜਰ ਟੈਕਸੀ ਸਟੈਂਡ ਤੋਂ ਗੱਲ ਕਰ ਰਹੇ ਹੋ ਜੀ ਹਾਂਜੀ ਸਰ ਮੈਂ ਅੱਜ ਤੁਹਾਡੀ ਗੱਡੀ ਬੁੱਕ ਕਰਵਾਈ ਸੀਗੀ ਜੋ ਗੱਡੀ ਮੇਰੇ ਕੋਲ ਪਹੁੰਚੀ ਹੈ ਮੈਂ ਉਹਦੇ ਸਫ਼ਰ ਕੀਤਾ ਬਟ ਮੈਨੂੰ ਸਫ਼ਰ ਕਰਕੇ ਥੋੜੀ ਨਿਰਾਸ਼ਾ ਹੋਈ ਹੈ ਅਤੇ ਮੈਂ ਜਿੱਥੇ ਦੱਸਣਾ ਚਾਹਾਂਗਾ ਜਿਹੜਾ ਤੁਹਾਡਾ ਡਰਾਈਵਰ ਸੀਗਾ ਉਹਨੇ ਪ੍ਰੋਪਰ ਨਾ ਤਾਂ ਮਾਸਕ ਪਹਿਨਿਆ ਸੀਗਾ ਤੁਹਾਡੀ ਗੱਡੀ ਦੀਆਂ ਜਿਹੜੀ ਸਫ਼ਾਈ ਹੈਗੀ ਹੈ ਸਫ਼ਾਈ ਬਿਲਕੁਲ ਵੀ ਨਹੀਂ ਸੀਗੀ ਗੱਡੀ ਦੇ ਵਿੱਚ ਕਾਫ਼ੀ ਜ਼ਿਆਦਾ ਕਚਰਾ ਜੋ ਫੈਲਿਆ ਸੀਗਾ ਅਤੇ ਗੱਡੀ ਦਾ ਜੋ ਜੋ ਹਾਲਤ ਹੈ ਉਹ ਵੀ ਖਸਤਾ ਹਾਲਤ ਗੱਡੀ ਸੀਗੀ ਅਤੇ ਜਿਹੜੀ ਇਹ ਮੈਨੂੰ ਗੱਡੀ ਦਾ ਸਫ਼ਰ ਕਰਨਾ ਬਿਲਕੁਲ ਵੀ ਪਸੰਦ ਨਹੀਂ ਆਇਆ ਮੈਂ ਨਹੀਂ ਚਾਹੁੰਦਾ ਵੀ ਤੁਹਾਡੀ ਕੰਪਨੀ ਦੇ ਅੱਗੇ ਰੈਪੂਟੇਸ਼ਨ ਖ਼ਰਾਬ ਹੋਵੇ ਅਤੇ ਗੱਡੀ ਦਾ ਜੋ ਏ ਸੀ ਸੀਗਾ ਉਹ ਵੀ ਪ੍ਰੋਪਰ ਵਰਕ ਨਹੀਂ ਕਰ ਰਿਹਾ ਸੀਗਾ ਜਿਸ ਕਾਰਨ ਮੈਨੂੰ ਸਫ਼ਰ ਕਰਨ 'ਚ ਪਰੇਸ਼ਾਨੀ ਹੋਈ ਹਾਂ ਤਾਂ ਜਿਹੜੀ ਆਪਣੀ ਗੱਡੀ ਗੱਡੀਆਂ ਦੀ ਕੰਡੀਸ਼ਨ ਹੈ ਇਸ ਬਾਰੇ ਵਿਸ਼ੇਸ਼ ਧਿਆਨ ਦਿਓ ਤਾਂ ਜੋ ਕਸਟਮਰਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਮੈਂ ਤਾਂ ਇਹ ਮੇਰਾ ਜਿੰਨਾ ਐਕਸਪੀਰੀਅੰਸ ਰਿਹਾ ਤਾਂ ਮੈਂ ਇਹ ਅੱਗੇ ਤੋਂ ਤੁਹਾਡੀ ਜਿਹੜੀ ਕੈਬ ਹੈਗੀ ਆ ਮੈਂ ਬਿਲਕੁਲ ਵੀ ਬੁੱਕ ਨਹੀਂ ਕਰਾਂਗਾ ਠੀਕ ਹੈ ਜੀ ਧੰਨਵਾਦ